ਹਾਂਜੀ ਹਾਂਜੀ ਤੁਸੀਂ ਦੱਸੋ ਹਾਂਜੀ ਹਾਂਜੀ ਦੱਸੋ ਅੱਛਾ ਹਾਂਜੀ ਮਨਜੋਤ ਦੱਸੋ ਕਿਹੜੀ ਦੀ ਮਨਜੋਤ ਅੱਛਾ ਉਹਾ ਤਾਂ ਮੈਨੂੰ ਦਈ ਨੂੰ ਬਹੁਤ ਟਾਈਮ ਹੋ ਗਿਆ ਹਾਂ ਮੁਝੇ ਪੁੱਛੋ ਅੱਛਾ ਵੀ ਓਕੇ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਪ੍ਰੈਜੈਂਟੇਸ਼ਨ ਬਣਾਉਣੀ ਹੈ ਠੀਕ ਹੈ ਪ੍ਰੈਜੈਂਟੇਸ਼ਨ 'ਚ ਤੁਸੀਂ ਮੈਨੂੰ ਸਾਰੇ ਫਰੀਡਮ ਫਾਈਟਰਸ ਦੀ ਫੋਟੋ ਲਗਾਣੀ ਤੁਸੀਂ ਦੋ ਜਾਂ ਤਿੰਨ ਫਰੀਡਮ ਫਰੀਡਮ ਫਾਈਟਰਸ ਦੀ ਫੋਟੋ ਲਗਾਣੀ ਹੈ ਅਤੇ ਉਸ ਫੋਟੋ ਦੇ ਥੱਲੇ ਉਹ ਤੁਸੀਂ ਮੈਨੂੰ ਬਰੀਫ ਦੇਣਾ ਕਿ ਉਹਨਾਂ ਦੀ ਹਿਸਟਰੀ ਕੀ ਸੀਗੀ ਬਰਥ ਕਿੱਥੋਂ ਦਾ ਕਿਹੜੇ ਪਿੰਡ ਦਾ ਬਰਥ ਆ ਠੀਕ ਹੈ ਉਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿੱਥੋਂ ਤੱਕ ਪੜ੍ਹਾਈ ਕੀਤੀ ਕਿਹੜੇ ਜ਼ਿਲ੍ਹੇ ਦੇ ਹੈ ਅਤੇ ਮਾਲਵੇ ਦੇ ਮਾਝੇ ਦੇ ਆ ਦੁਆਬੇ ਦੇ ਆ ਕਿੱਧਰ ਦੇ ਆ ਅਤੇ ਉਹਨਾਂ ਨੇ ਆਪਣੇ ਦੇਸ਼ ਵਾਸਤੇ ਕਿਆ ਕਰਿਆ ਠੀਕ ਹੈ ਕਿਵੇਂ ਫਰੀਡਮ ਫਾਈਟਰਸ ਵਾਲੀ ਲਾਈਨ 'ਚ ਵੜੇ ਉਹਨਾਂ ਨਾਲ ਕਿਆ ਇੱਦਾਂ ਦਾ ਹੋਇਆ ਕਿ ਉਹਨਾਂ ਨੇ ਆਪਣਾ ਸਾਰਾ ਹੀ ਆਪਣਾ ਜਿਹੜਾ ਕਰੀਅਰ ਦਾ ਰੁੱਖ ਆ ਉਹ ਐਂਏ ਕਰ ਲਿਆ ਕਿ ਮੈਂ ਆਪਣੇ ਦੇਸ਼ ਪ੍ਰਤੀ ਬਚਾਉਣਾ ਮੈਂ ਆਪਣੇ ਦੇਸ਼ ਨੂੰ ਬਚਾਉਣਾ ਜਾਂ ਉਹਨਾਂ ਨਾਲ ਇੱਦਾਂ ਦਾ ਕਿਆ ਕੀਤਾ ਕਿ ਮੈਂ ਸਿਸਟਮ ਚੇਂਜ ਕਰਨਾ ਸਾਰਾ ਸਮਝ ਰਹੇ ਓ ਤੁਸੀਂ ਮੈਨੂੰ ਆਹ ਸਾਰੀ ਡਿਟੇਲਸ ਲਿਖ ਕੇ ਦੇਣੀ ਹੈ ਹਿਸਟਰੀ ਉਹਨਾਂ ਉਹਨਾਂ ਬਾਰੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਆ ਕਿਆ ਕਰਿਆ ਸਾਡੇ ਦੇਸ਼ ਲਈ ਅਤੇ ਕੀ ਕੀ ਉਹਨਾਂ ਦੀ ਹੈਲਪ ਸੀਗੀ ਜਿਸ ਵਾਸਤੇ ਸਾਡੇ ਰੂਲਸ ਸਾਡੇ ਕੋਨਸਟੀਟਿਊਸ਼ਨ ਚੇਂਜ ਹੋਇਆ ਹਾਂਜੀ ਊਧਮ ਸਿੰਘ ਜੀ ਹਾਂਜੀ ਤੁਸੀਂ ਮੈਨੂੰ ਦੋ ਕੋਈ ਗੱਲ ਨਹੀਂ ਤੁਸੀਂ ਪੁੱਤ ਓਨਲਾਈ ਦੇਖ ਲੋ ਓਨਲਾਈਨ ਤੁਹਾਨੂੰ ਸਭ ਕੁਛ ਮਿਲ ਜਾਣਾ ਉਹਨਾਂ ਉਹਨਾਂ ਦੀ ਹਿਸਟਰੀ ਬਾਰੇ ਕਿੱਥੋਂ ਦਾ ਬਰਥ ਆ ਆਹ ਲੱਭ ਜਾਣਾ ਹਾਂਜੀ ਹਾਂਜੀ ਤੁਸੀਂ ਸਾਰਾ ਲਿਖਣਾ ਉਹਨਾਂ ਦਾ ਤੁਸੀਂ ਮੈਨੂੰ ਸਲਾਈਡਸ ਇਹਨਾਂ ਦੀ ਘੱਟੋ ਘੱਟ ਚਾਰ ਚਾਰ ਹੋਵੇ ਸਾਰਿਆਂ ਦੀ ਕਿਉਂਕੀ ਜਿਹੜੀ ਤੁਹਾਡੀ ਪ੍ਰੈਜੈਂਟੇਸ਼ਨ ਦੇ ਪੇਜੀਸ ਆ ਉਹ ਮੈਨੂੰ ਚਾਹੀਦੇ ਹੈ ਘੱਟੋ ਘੱਟ ਪੱਚੀ ਕੁ ਹੋਣ ਤਾਂ ਸਾਰਿਆਂ ਦੇ ਚਾਰ ਚਾਰ ਪ੍ਰੈਜੈਂਟੇਸ਼ਨ ਦੇ ਅਲੱਗ ਤੋਂ ਉਹ ਕਿੱਥੇ ਕਿੱਥੇ ਉਹਨਾਂ ਦੀ ਫੋਟੋ ਠੀਕ ਹੈ ਉਹਨਾਂ ਦਾ ਘਰ ਕਿਵੇਂ ਸੀਗਾ ਉਹ ਉਹਨਾਂ ਦੀ ਜਿਵੇਂ ਅੱਜ ਕੱਲ੍ਹ ਕਾਫੀ ਫੋਟੋ ਆਉਂਦੀਆਂ ਪੁਰਾਣੀ ਪੁਰਾਣੀ ਜੇਲ੍ਹ 'ਚ ਕਿਵੇਂ ਸੀਗੇ ਬਹੁਤ ਪੁੱਲ ਬਹੁਤ ਪੁਰਾਣੇ ਟਾਈਮ ਦੀ ਓਨਲਾਈਨ ਕਾਫੀ ਚੜ੍ਹੀਆਂ ਹੋਈਆਂ ਉਹ ਤੁਸੀਂ ਪਾ ਦੋ ਠੀਕ ਹੈ ਉਹਨੂੰ ਐਂ ਐਂ ਇਸ ਤਰ੍ਹਾਂ ਵਧੀਆ ਪੇਸ਼ ਕਰਨਾ ਵੀ ਤੁਸੀਂ ਕੋਲੇਜ ਦੇ ਬੱਚੇ ਹੋ ਕਿਸੀ ਸਕੂਲ ਦੇ ਬੱਚਿਆਂ ਵਾਂਗੂ ਨਾ ਪ੍ਰੈਜੈਂਟੇਸ਼ਨ ਲੈ ਕੇ ਆਇਓ ਮੇਰੇ ਕੋਲ

ਅੱਛਾ ਵੇਖ ਫਿਰ ਐਂਏ ਕਰੋ ਤੁਸੀਂ ਜੇ ਤੁਹਾਨੂੰ ਇਨਫੋਰਮੇਸ਼ਨ ਘੱਟ ਮਿਲਦੀ ਹੈ ਤਾਂ ਤੁਸੀਂ ਐਂਏ ਕਰੋ ਤੁਸੀਂ ਨਾ ਇੱਕ ਹੋਰ ਫਰੀਡਮ ਫਾਈਟਰ ਬਾਰੇ ਲਿਖ ਦੋ ਇੱਕ ਤੁਸੀਂ ਕੋਈ ਹੋਰ ਸਰਚ ਕਰ ਲੋ ਜਾਂ ਤੁਹਾਨੂੰ ਪਤਾ ਹੋਣਾ ਕੋਈ ਉਹਨਾਂ ਬਾਰੇ ਲਿਖ ਦੋ ਤਾਂ ਫਿਰ ਉਹ ਤੁਹਾਡੀ ਜਿਹੜੀ ਰਿਕੁਾਇਰਮੈਂਟ ਆ ਉਹ ਪੂਰੀ ਹੋ ਜਾਣੀ ਹੈ ਹਾਂ ਜਿਵੇਂ ਖੱਟਕੜ ਕਲਾ 'ਚ ਜੰਮੇ ਸੀਗੇ ਉਹ ਠੀਕ ਹੈ ਉਤੋਂ ਬਾਅਦ ਉਹਨਾਂ ਦਾ ਕਿਵੇਂ ਇੱਕਦਮ ਰੁੱਖ ਬਦਲਿਆ ਠੀਕ ਹੈ ਤੁਸੀਂ ਊਧਮ ਸਿੰਘ ਦਾ ਲਿਖ ਦੋ ਊਧਮ ਊਧਮ ਸਿੰਘ ਦੇ ਉੱਪਰ ਤਾਂ ਮੂਵੀ ਵੀ ਆਈ ਹੈ ਥੋੜ੍ਹੀ ਦੇਰ ਪਹਿਲਾਂ ਠੀਕ ਹੈ ਅਤੇ ਅਤੇ ਫਿਰ ਚੰਦਰਸ਼ੇਖਰ ਆਜ਼ਾਦ ਸੀਗੇ ਉਹਨਾਂ ਦੇ ਉੱਪਰ ਲਿਖ ਦੋ ਤੁਸੀਂ ਫਰੀਡਮ ਫਾਈਟਰ ਦੇ ਉੱਪਰ ਉਹ ਕਿੱਦਾਂ ਦੇ ਸੀਗੇ ਉਹ ਭਗਤ ਹਾਂ ਮੇਨ ਮੇਨ ਅਤੇ ਬਿਲਕੁਲ ਇਮਪੋਰਟੈਂਟ ਲਾਈਨਾਂ ਉਹ ਲਿਖਣੀਆਂ ਏ ਹਾਂ ਅਤੇ ਇਹਨਾਂ 'ਤੇ ਜੇ ਤੁਸੀਂ ਵੀਡੀਓ ਬਣਾ ਸਕਦੇ ਓਂ ਤਾਂ ਵੀਡੀਓ ਵੀ ਬਣਾ ਦਿਓ ਜਿਵੇਂ ਓਨਲਾਈਨ ਮਿਲ ਜਾਂਦੀਆਂ ਹੁੰਦੀਆਂ ਠੀਕ ਆ ਹੁਣ ਭਗਤ ਸਿੰਘ ਅਤੇ ਊਧਮ ਸਿੰਘ ਦੇ ਉੱਪਰ ਤਾਂ ਮੂਵੀਆਂ ਕਾਫੀ ਬਣੀ ਹੋਈਆਂ ਅਜੇ ਦੇਵਗਨ ਨੇ ਬਣਾਈ ਹੋਈ ਆ ਉਤੋਂ ਬਾਅਦ ਇੱਕ ਹੁਣੀ ਵਿੱਕੀ ਕੌਸ਼ਲ ਨੇ ਬਣਾਈ ਸੀ ਊਧਮ ਸਿੰਘ ਦੇ ਉੱਪਰ ਵੈਸੇ ਉਦੋਂ ਉਹ ਮੂਵੀ ਹੁਣ ਦੋਖੋ ਅਤੇ ਉਧਰੋਂ ਉੱਥੋਂ ਦੇਖੋਗੇ ਇੰਪੋਰਟੈਂਟ ਕਿਆ ਕਿਆ ਚੀਜ਼ ਹੈ ਅਤੇ ਉਹ ਚੀਜ਼ਾਂ ਤੁਸੀਂ ਆਪਣੀ ਫਾਈਲ 'ਚ ਪਾ ਕੇ ਲਿਆਓ ਮੇਰੇ ਕੋਲ

ਕੀ ਕਹਿ ਰਹੇ ਹੋ ਹਾਂਜੀ ਕੋਈ ਗੱਲ ਨਹੀਂ ਤੁਸੀਂ ਜੱਦ ਕੋਲੇਜ ਆਉਂਗੇ ਤਾਂ ਤੱਦ ਦੇ ਦਿਓ ਪੁੱਤ ਮੈਨੂੰ

ਕੋਈ ਗੱਲ ਨਹੀਂ ਐਨੀ ਟਾਈਮ